ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਹਿਕ ਹੈ ਮੈਂ ਗੁਰਦਾਸਪੁਰ ਤੋਂ ਬੋਲ ਰਹੀ ਹਾਂ ਮੈਂ ਇੱਕ ਕਾਰ ਬੁੱਕ ਕਰਵਾਉਣਾ ਕਰਵਾਉਣਾ ਚਾਹੁੰਦੀ ਹਾਂ ਜੀ ਅਸੀਂ ਪਰਸੋਂ ਸਵੇਰੇ ਅੱਠ ਵਜੇ ਗੁਰਦਾਸਪੁਰ ਤੋਂ ਅੰਮ੍ਰਿਤਸਰ ਜਾਣਾ ਹੈ ਅਤੇ ਰਾਤ ਨੂੰ ਅਸੀਂ ਅੱਠ ਵਜੇ ਤੱਕ ਵਾਪਸ ਘਰ ਆਉਣਾ ਹੈ ਮੇਰੇ ਨਾਲ ਤਿੰਨ ਚਾਰ ਜਣੇ ਹੋਰ ਨੇ ਅਸੀਂ ਟੋਟਲ ਪੰਜ ਜਣੇ ਹਾਂ ਤੁਸੀਂ ਮੈਨੂੰ ਆਪਣੀ ਤੁਸੀਂ ਮੈਨੂੰ ਆਪਣੀ ਟੈਕਸੀ ਦੀ ਪੂਰੀ ਡਿਟੇਲ ਦੇ ਦਿਓ ਕਿ ਤੁਹਾਡੇ ਕੋਲ ਉਹ ਟਾਈਮ 'ਤੇ ਕੋਈ ਕਾਰ ਟੈਕਸੀ ਅਵੇਲੇਬਲ ਹੈ ਜਾਂ ਨਹੀਂ ਹੈ ਅਗਰ ਹੈ ਤਾਂ ਉਹਦਾ ਪ੍ਰਾਈਸ ਕੀ ਹੈ ਤੁਸੀਂ ਸਾਨੂੰ ਸਵੇਰੇ ਲੈ ਕੇ ਜਾ ਸਕਦੇ ਹੋ ਅਤੇ ਟਾਈਮ ਨੂੰ ਘਰ ਵਾਪਸੀ 'ਤੇ ਆ ਸਕਦੇ ਹੋ ਕਿਉਂਕਿ ਸਾਡੇ ਨਾਲ ਛੋਟੇ ਬੇਬੀਸ ਵੀ ਨੇ ਤਾਂ ਇਸ ਕਰਕੇ